ਭੰਗੜਾ ਨਾ ਸਿਰਫ਼ ਇੱਕ ਨਾਚ ਹੈ ਬਲਕਿ ਇਹ ਇੱਕ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਇਹ ਖੁਸ਼ੀ ਉਤਸ਼ਾਹ ਅਤੇ ਜੀਵਨ ਦੇ ਜਸ਼ਨ ਦਾ ਪ੍ਰਤੀਕ ਹੈ ਪੰਜਾਬੀ ਭੰਗੜਾ ਹਰੇਕ ਤਿਉਹਾਰ ਦਾ ਅਨਿੱਖੜਵਾਂ ਅੰਗ ਬਣ ਚੁੱਕਿਆ ਕਿਉਂਕਿ ਇਹਦੇ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਨਾ ਹੋਵੇ ਭੰਗੜਾ ਖੁਸ਼ੀ ਉਤਸ਼ਾਹ ਅਤੇ ਜੀਵਨ ਦੇ ਜਸ਼ਨ ਦਾ ਪ੍ਰਗਟਾਵਾ ਹੈ ਇਹ ਖੇਤਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਆਰਾਮ ਕਰਨ ਅਤੇ ਖੁਸ਼ੀ ਮਨਾਉਣ ਦਾ ਵੀ ਇੱਕ ਤਰੀਕਾ ਹੈ ਜਦੋਂ ਨਵੀਆਂ ਫਸਲਾਂ ਆਉਂਦੀਆਂ ਹਨ ਵੱਢੀਆਂ ਜਾਂਦੀਆਂ ਹਨ ਉਦੋਂ ਲੋਕ ਭੰਗੜੇ ਦੇ ਰੂਪ ਦੇ ਵਿੱਚ ਹੀ ਖੁਸ਼ੀਆਂ ਆਪਣੀਆਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਨ ਇਹ ਭੰਗੜਾ ਸਾਡੀ ਸੱਭਿਆਚਾਰਕ ਪਛਾਣ ਭੰਗੜਾ ਪੰਜਾਬੀ ਸੱਭਿਆਚਾਰ ਦੀ ਪਛਾਣ ਹੈ ਇਹ ਪੰਜਾਬੀਆਂ ਦੀ ਮਿਹਨਤ ਲਚਕੀਲੇਪਣ ਅਤੇ ਖੁਸ਼ੀ ਦਾ ਪ੍ਰਤੀਕ ਹੈ ਭੰਗੜਾ ਸਮਾਜਿਕ ਬੰਧਨ ਵੀ ਹੈ ਭੰਗੜਾ ਲੋਕਾਂ ਨੂੰ ਇਕੱਠਾ ਕਰਦਾ ਹੈ ਅਤੇ ਸਮਾਜਿਕ ਬੰਧਨ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਤਿਉਹਾਰਾਂ ਵਿਆਹਾਂ ਵਿਚ ਲੋਕਾਂ ਨੂ ਇਕ ਦੂਜੇ ਨਾਲ ਜੁੜਨ ਦੇ ਮੋਕੇ ਪ੍ਰਦਾਨ ਕਰਦਾ ਹੈ ਭੰਗੜਾ ਸਰੀਰ ਅਤੇ ਮਨ ਲਈ ਫ਼ਾਇਦੇਮੰਦ ਹੁੰਦਾ ਹੈ ਭੰਗੜੇ ਦੀਆਂ ਸਰੀਰਕ ਗਤੀਵਿਧੀਆਂ ਜੋ ਕਿ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਅਤੇ ਮਨ ਨੂੰ ਖੁਸ਼ੀ ਦਿੰਦੀਆਂ ਹਨ ਪੰਜਾਬੀ ਸੰਗੀਤ ਦਾ ਪ੍ਰਚਾਰ ਭੰਗੜਾ ਪੰਜਾਬੀ ਸੰਗੀਤ ਨੂੰ ਦੁਨੀਆਂ ਭਰ ਵਿੱਚ ਪ੍ਰਸਿੱਧ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਭੰਗੜਾ ਹੁਣ ਪੰਜਾਬੀ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ ਤਿਉਹਾਰਾਂ ਦੌਰਾਨ ਭੰਗੜੇ ਦਾ ਆਨੰਦ ਸਾਰੇ ਸ ਲੋਕ ਲੈਂਦੇ ਹਨ